ਹਾਂ ਮੈਂ ਪ੍ਰੈਸ਼ਰ ਕੁੱਕਰ ਦੀ ਵਰਤੋਂ ਖਾਣਾ ਬਣਾਉਣ ਲਈ ਕਰਦਾ ਹਾਂ ਕਿਉਂਕੀ ਪ੍ਰੈਸ਼ਰ ਕੁੱਕਰ ਵਿੱਚ ਖਾਣਾ ਬਣਾਉਣਾ ਬਹੁਤ ਹੀ ਆਸਾਨ ਹੈ ਅਤੇ ਟਾਇਮ ਦੀ ਬਚਤ ਵੀ ਕਰਦਾ ਹੈ ਜਦਕਿ ਇਸਦੇ ਉਲਟ ਖੁੱਲੇ ਭਾਂਡਿਆਂ ਵਿੱਚ ਖਾਣਾ ਬਣਾਉਣ ਲਈ ਬਹੁਤ ਸਮਾਂ ਲੱਗਦਾ ਹੈ ਅਤੇ ਇਹ ਥੋੜ੍ਹੀ ਥੋੜ੍ਹੀ ਦੇਰ ਬਾਅਦ ਚੈੱਕ ਕਰਨਾ ਪੈਂਦਾ ਹੈ ਜਦਕਿ ਪ੍ਰੈਸ਼ਰ ਕੁੱਕਰ ਵਿੱਚ ਸਾਰੀ ਸਮੱਗਰੀ ਪਾਉਣ ਤੋਂ ਬਾਅਦ ਸਿਰਫ ਉਹਦੇ ਤਿੰਨ ਚਾਰ ਸੀਟੀਆਂ ਬਾਅਦ ਇੰਤਜ਼ਾਰ ਕਰਨਾ ਪੈਂਦਾ ਹੈ ਅਤੇ ਉਸ ਬਾਅਦ ਆਪਾਂ ਖਾਣਾ ਦੇਖ ਸਕਦੇ ਹਾਂ ਕਿ ਪੱਕ ਚੁੱਕਿਆ ਹੈ ਕੁ ਪ੍ਰੈਸ਼ਰ ਕੁੱਕਰ ਵਿੱਚ ਖਾਣਾ ਛੇਤੀ ਪੱਕ ਜਾਂਦਾ ਹੈ ਅਤੇ ਖਾਣੇ ਦਾ ਸਵਾਦ ਵੀ ਵੱਖਰਾ ਹੁੰਦਾ ਹੈ ਕਿਉਂਕੀ ਪ੍ਰੈਸ਼ਰ ਕੁੱਕਰ ਵਿੱਚ ਖਾਣੇ ਵਿੱਚ ਪਾਏ ਗਏ ਮਸਾਲੇ ਚੰਗੀ ਤਰ੍ਹਾਂ ਘੁੱਲ ਚੁੱਕੇ ਹੁੰਦੇ ਹਨ ਅਤੇ ਖਾਣਾ ਚੰਗੀ ਤਰ੍ਹਾਂ ਪੱਕ ਚੁੱਕਾ ਹੁੰਦਾ ਹੈ ਜਿਸ ਕਰਕੇ ਖਾਣੇ ਦਾ ਸਵਾਦ ਵੱਖਰਾ ਆਉਂਦਾ ਹੈ ਪ੍ਰੈਸ਼ਰ ਕੁੱਕਰ ਵਿੱਚ ਖਾਣਾ ਬਹੁਤ ਕੁਆਂਟਿਟੀ ਵਿੱਚ ਵੀ ਬਣ ਜਾਂਦਾ ਹੈ ਜਦ ਕੀ ਖੁੱਲੇ ਭਾਂਡਿਆ ਵਿੱਚ ਖਾਣਾ ਉਨਾ ਕੁਆਂਟਿਟੀ ਵਿੱਚ ਨਹੀਂ ਬਣਦਾ ਜਿੰਨਾ ਕਿ ਪ੍ਰੈਸ਼ਰ ਕੁੱਕਰ ਵਿੱਚ ਬਣ ਜਾਂਦਾ ਹੈ